ਵੀਹ ਮਾਰਚ ਦੋ ਹਜ਼ਾਰ ਦੋ ਫਰਵਰੀ ਦੋ ਹਜ਼ਾਰ ਚਾਰ ਨੌ ਅਕਟੂਬਰ ਦੋ ਹਜ਼ਾਰ ਦੋ ਸੱਤ ਅਪ੍ਰੈਲ ਦੋ ਹਜ਼ਾਰ ਛੇ ਸਤਾਰਾਂ ਜਨਵਰੀ ਦੋ ਹਜ਼ਾਰ ਤੇਰ੍ਹਾਂ